ਜੇਕਰ ਅਸੀਂ ਗਾਇਕੀ ਦੀ ਗਤੀਸ਼ੀਲਤਾ ਦੀ ਗੱਲ ਕਰੀਏ ਤਾਂ ਗਾਇਕੀ ਦੇ ਵਿੱਚ ਸਭ ਤੋਂ ਪਹਿਲਾਂ ਰਿਆਜ਼ ਜ਼ਰੂਰੀ ਹੈ ਜੋ ਕਿ ਸਾਡੇ ਗਲੇ ਨਾਲ ਜਿਹਦਾ ਕਿ ਸਿੱਧਾ ਸਿੱਧਾ ਸੰਬੰਧ ਹੈ ਅਗਰ ਸਾਡਾ ਗਲਾ ਬੇਸੁਰਾ ਹੋਏਗਾ ਤਾਂ ਸਾਡੀ ਗ ਗਾਇਕੀ ਦੇ ਵਿੱਚ ਕਦੇ ਵੀ ਗਤੀਸ਼ੀਲਤਾ ਨਹੀਂ ਆਵੇਗੀ ਅਗਰ ਸਾਡਾ ਗਲਾ ਸੁਰ ਵਿੱਚ ਹੋਏਗਾ ਤਾਂ ਸਾਡੀ ਗਾਇ ਗਾਇਕੀ ਦੀ ਗਤੀਸ਼ੀਲਤਾ ਆਉਂਦੀ ਰਹੇਗੀ ਐਂਡ ਜੇ ਗਤੀਸ਼ੀਲਤਾ ਦੀ ਗੱਲ ਕਰੀਏ ਤਾਂ ਅਸੀਂ ਗਤੀਸ਼ੀਲਤਾ ਕਿੱਦਾਂ ਆਵੇਗੀ ਜੇ ਅਸੀਂ ਇਸ ਗੱਲ ਇਸ ਗੱਲ 'ਤੇ ਵਿਚਾਰ ਕਰੀਏ ਤਾਂ ਗਤੀਸ਼ੀਲਤਾ ਸਿਰਫ ਔਰ ਸਿਰਫ ਸਾਡੇ ਰਿਆਜ਼ ਕਰਨ ਨਾਲ ਗਲੇ ਦੇ ਸੁਰ ਨਾਲ ਆਏਗੀ ਅਤੇ ਗਲੇ ਦਾ ਸੁਰ ਉਹ ਸਿਰਫ ਰਿਆਜ਼ ਨਾਲ ਆਏਗਾ ਅਗਰ ਅਸੀਂ ਸੁਬਾਹ ਦੇ ਟਾਇਮ ਰਿਆਜ਼ ਕਰਦੇ ਹਾਂ ਔਰ ਸ਼ਾਮ ਦੇ ਟਾਇਮ ਰਿਆਜ਼ ਕਰਦੇ ਹਾਂ ਤਾਂ ਗਤੀਸ਼ੀਲਤਾ ਸਾਡੇ ਗਲੇ ਦੇ ਵਿੱਚ ਸਾਡੀ ਗਾਇਕੀ ਦੇ ਵਿੱਚ ਆਪਣੇ ਆਪ ਆਏਗੀ ਗਲੇ ਦੇ ਵਿੱਚ ਨਿਖਾਰ ਆਏਗਾ ਗਲੇ ਦੇ ਵਿੱਚ ਸੁਰ ਬੈਠਣਗੇ ਸੁਰ ਸੰਗਤੀਆਂ ਸਮਝ ਆਉਣਗੀਆਂ ਤਾਨਾਂ ਮੁਰਕੀਆਂ ਖਟਕੇ ਕਈ ਪ੍ਰਕਾਰ ਦੀਆਂ ਜਿਲ ਜਿਹੜੀਆਂ ਕਿ ਗਾਇਕੀ ਦੀਆਂ ਮਤਲਬ ਕਿ ਹਰਕਤਾਂ ਨੇ ਬਰੀਕ ਹਰਕਤਾਂ ਨੇ ਉਹ ਸਾਡੇ ਪਕੜ ਦੇ ਵਿੱਚ ਆਣਗੀਆਂ ਸਾਨੂੰ ਉਹਨਾਂ ਬਾਰੇ ਨੋਲਜ ਆਏਗੀ ਨੋਲਜ ਆਏਗੀ ਐਂਡ ਸਾਡੇ ਗਲੇ ਦੇ ਵਿੱਚ ਸੁਰ ਬੈਠਣਗੇ ਤਾਂ ਉਹਨਾਂ ਨੂੰ ਅਸੀਂ ਆਪਣੇ ਗੀਤਾਂ ਦੇ ਵਿੱਚ ਜਦੋਂ ਅਸੀਂ ਲਗਾਵਾਂਗੇ ਤਾਂ ਸਾਡੀ ਗਾਇ ਗਾਇਕੀ ਦੇ ਵਿੱਚ ਹੋਰ ਵੀ ਸੁਧਾਰ ਆਏਗਾ ਅਤੇ ਨਿਖਾਰ ਆਏਗਾ ਅਤੇ ਸਾਡੀ ਗਾਈਕੀ ਹੈ ਜਿਹੜੀ ਉਹ ਪ੍ਰਭਾਵਸ਼ਾਲੀ ਬਣੇਗੀ ਸਭ ਤੋਂ ਵੱਧ ਗਾਇਕੀ ਦੀ ਗਤੀਸ਼ੀਲਤਾ ਦੇ ਵਿੱਚ ਆਵਾਜ਼ ਮੈਟਰ ਕਰਦੀ ਹੈ ਅਗਰ ਤੁਹਾਡੀ ਆਵਾਜ਼ ਅੱਛੀ ਹੈ ਤਾਂ ਤੁਹਾਡੀ ਗਾਇਕੀ ਬੇਸ਼ੱਕ ਸ਼ਿਦ ਸਿੱਧੀ ਗਾਇਕੀ ਹੈ ਜਾਂ ਕਲਾਸੀਕਲ ਗਾਇਕੀ ਹੈ ਜਾਂ ਫੋਕ ਹੈ ਜਾਂ ਕਲਾਸੀਕਲ ਆ ਤਾਂ ਉਹ ਸਭ ਨੂੰ ਵਧੀਆ ਲੱਗੇਗਾ ਅਗਰ ਤੁਹਾਡੀ ਆਵਾਜ਼ ਅੱਛੀ ਨਹੀਂ ਤਾਂ ਤੁਸੀ ਜੇ ਕਲਾਸੀਕਲ ਗਾ ਰਹੇ ਓਂ ਭਾਵੇਂ ਤੁਸੀਂ ਫੋਕ ਗਾ ਰਹੇ ਓਂ ਤਾਂ ਉਹ ਕਿਸੇ ਨੇ ਤੁਹਾਡਾ ਇੰਨਾ ਵਧੀਆ ਨਹੀਂ ਮੰਨਣਾ ਅਤੇ ਇਸ ਕਰਕੇ ਆਵਾਜ਼ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ ਅਤੇ ਆਵਾਜ਼ ਨੂੰ ਸੁਧਾਰ ਲਈ ਸਿਰਫ ਇੱਕੋ ਇੱਕ ਮੰਤਰ ਹੈ ਉਹ ਹੈ ਰਿਆਜ਼ ਰਿਆਜ਼ ਦੇ ਵਿੱਚ ਜਿੱਦਾਂ ਕਿ ਅਸੀਂ ਸਵੇਰੇ ਓਮ ਦਾ ਰਿਆਜ਼ ਕਰਦੇ ਹਾਂ ਜਾਂ ਸਾਹ ਦਾ ਰਿਆਜ਼ ਕਰਦੇ ਹਾਂ ਸਵੇਰ ਦੇ ਟਾਇਮ ਅਸੀਂ ਇੱਕ ਘੰਟਾ ਵੀ ਅਗਰ ਸਾਹ ਦਾ ਰਿਆਜ਼ ਕਰਦੇ ਹਾਂ ਤਾਂ ਸਾਡੇ ਗਲੇ ਦੇ ਵਿੱਚ ਆਟੋਮੈਟਕਲੀ ਸੁਰ ਬੈਠਣ ਲੱਗਦੇ ਹਨ ਅਤੇ ਜਿਹਦੇ ਕਰਕੇ ਸਾਡੇ ਗਲੇ ਦੇ ਵਿੱਚ ਨਿਖਾਰ ਆਉਣਾ ਸ਼ੁਰੂ ਹੁੰਦਾ ਹੈ ਅਤੇ ਸਾਡੀ ਗਾਇਕੀ ਦੇ ਵਿੱਚ ਵੀ ਗਤੀਸ਼ੀਲਤਾ ਬਣਦੀ ਹੈ ਦੂਸਰੀ ਗੱਲ ਅਸੀਂ ਵਾਕਾਂਸ਼ ਅਤੇ ਵਿਆਖਿਆ ਦੀ ਗੱਲ ਕਰੀਏ ਉਹ ਗੀਤਾਂ ਦੇ ਵਿੱਚ ਵਿਸ਼ੇ ਦੇ ਹਿਸਾਬ ਨਾਲ ਟੋਪਿਕ ਦੇ ਹਿਸਾਬ ਦੇ ਨਾਲ ਲਏ ਜਾਂਦੇ ਨੇ ਅਗਰ ਅਸੀਂ ਕੋਈ ਇਤਿਹਾਸਕ ਜਾਂ ਕੋਈ ਧਾਰਮਿਕ ਗੀਤ ਗਾਉਂਦੇ ਹਾਂ ਤਾਂ ਉਸ ਦੇ ਵਿੱਚ ਜਿੱਦਾਂ ਕਿ ਅਸੀਂ ਧਾਰਮਿਕ ਗੀਤਾਂ ਦੇ ਵਿੱਚ ਅਸੀਂ ਕੋਈ ਗੁਰਬਾਣੀ ਨਾਲ ਰਿਲੇਟਡ ਕੋਈ ਸੋਂਗ ਗਾ ਰਹੇ ਹਾਂ ਤਾਂ ਉਹਦੇ ਵਿੱਚ ਅਸੀਂ ਜੇਕਰ ਗੁਰ ਗੁਰਬਾਣੀ ਦੀ ਕੋਈ ਕੋਈ ਪੰਗਤੀ ਲੈਂਦੇ ਹਾਂ ਜਾਂ ਕੋਈ ਗੁਰਬਾਣੀ ਦਾ ਕੋਈ ਸ਼ਬਦ ਲੈਂਦੇ ਹਾਂ ਤਾਂ ਅਸੀਂ ਉਸਨੂੰ ਸੌਖੇ ਤਰੀਕੇ ਦੇ ਨਾਲ ਉੱਨਾਂ ਉਸਦੀ ਵਿਆਖਿਆ ਕਰਦੇ ਹਾਂ ਸੌਖੇ ਤਰੀਕੇ ਦੇ ਨਾਲ ਵਿਆਖਿਆ ਕਰਨ ਦਾ ਮਨੋਰਥ ਇਹ ਹੈ ਕਿ ਜਿਹੜਾ ਸੁਣਨ ਵਾਲੇ ਸਰੋਤੇ ਨੂੰ ਵੀ ਚੰਗਾ ਲੱਗੇ ਅਤੇ ਸੁਣਾਉਣ ਵਾਲੇ ਨੂੰ ਵੀ ਚੰਗਾ ਲੱਗੇ ਸੋ ਉਸਦਾ ਉਚਾਰਨ ਲਿਰਿਕਸ ਦੇ ਹਿਸਾਬ ਦੇ ਨਾਲ ਕੀਤਾ ਜਾਂਦਾ ਹੈ ਜਿੱਦਾਂ ਕਿ ਲਿਰਿਕਸ ਜਾ ਜ਼ਿਆਦਾ ਔਖੇ ਲਏ ਜਾਂਦੇ ਹਨ ਤਾਂ ਉਹ ਗਾਉ ਗਾਇਕੀ ਦੇ ਵਿੱਚ ਰੁਕਾਵਟ ਪਾਉਂਦੇ ਹਨ ਗਾਇਕੀ ਥੋੜ੍ਹੀ ਜਿਹੀ ਡਿਫੀਕਲਟ ਹੋ ਜਾਂਦੀ ਹੈ ਅਤੇ ਸੁਰ ਵੀ ਥੋੜ੍ਹਾ ਜਿਹਾ ਡਿਫੀਕਲਟ ਹੋ ਜਾਂਦਾ ਹੈ ਐਂਡ ਸੁਣਨ ਵਾਲੇ ਸਰੋਤੇ ਨੂੰ ਵੀ ਬੋਰਿੰਗ ਮਹਿਸੂਸ ਹੁੰਦਾ ਹੈ ਇਸ ਕਰਕੇ ਗੀਤਾਂ ਦੇ ਜਿਹੜੇ ਲਿਰਿਕਸ ਨੇ ਉਹ ਸੌਖੇ ਤਰੀਕੇ ਦੇ ਨਾਲ ਲਏ ਜਾਂਦੇ ਹਨ ਸੌਖੇ ਲਏ ਜਾਂਦੇ ਹਨ ਤਾਂ ਕਿ ਸੁਣਨ ਵਾਲੇ ਸਰੋਤੇ ਨੂੰ ਸਮਝ ਆ ਸਕਣ